ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੁਸੀਂ ਸਟੱਡੀ ਕੀ ਕੀਤੀ ਹੈ ਭਾਅ ਜੀ ਅੱਛਾ ਜੀ ਇਲੈਕਟ੍ਰੀਸ਼ਨ ਦੀ ਆਈ ਟੀ ਆਈ ਕੀਤੀ ਹੋਈ ਹੈ ਬੇਸੀਕੀਲੀ ਮੇਰੇ ਨਾਲ ਵੀ ਇੱਕ ਹੋਰ ਔਫਿਸ ਹੈ ਮੇਰੇ ਜਿੱਥੇ ਮੈਂ ਕੰਮ ਕਰਦਾ ਉੱਥੇ ਤਾਂ ਸੋਫਟਵੇਅਰ ਡਿਵਲੈਪਮੈਂਟ ਦਾ ਕੰਮ ਹੈ ਮੇਰਾ ਕੰਮ ਸੋੇਫਟਵੇਅਰ ਮੈਂ ਡੈਵਲਪ ਕਰਦਾ ਸੋਫਟਵੇਅਰ ਅਤੇ ਉੱਥੇ ਹੋਰ ਵੀ ਕਾਫੀ ਜੋਬ ਹੈਗੀਆਂ ਤੁਸੀਂ ਲਾ ਲਉ ਕਿ ਜੇ ਕਿਸੇ ਨੇ ਅਕਾਉਂਟਸ ਕੀਤਾ ਤਾਂ ਅਕਾਉਂਟਸ ਦਾ ਵੀ ਮਿਲ ਜਾਵੇਗਾ ਤੁਸੀਂ ਇਲੈਕਟ੍ਰੋਨਿਕਸ ਦਾ ਕੀਤਾ ਹੋਇਆ ਤਾਂ ਤੁਸੀਂ ਟੈਸਟਿੰਗ 'ਚ ਵੀ ਜਾ ਸਕਦੇ ਹੋ ਜਿੱਦਾਂ ਕਿ ਅਸੀਂ ਚੀਜ਼ ਸੋਫਟਵੇਅਰ ਬਣਾਇਆ ਫਿਰ ਟੈਸਟਰ ਹੁੰਦਾ ਹੈ ਕਿ ਤੁਸੀਂ ਕਿਸੇ ਦੇ ਤੁਸੀਂ ਉਹ ਸੋਫਟਵੇਅਰ ਨੂੰ ਟੈਸਟ ਕਰਨਾ ਹੈ ਚੰਗੀ ਤਰ੍ਹਾਂ ਚਲਾ ਕੇ ਯੇ ਵੋਹ ਕਿ ਇਹ ਠੀਕ ਵੀ ਹੈ ਸੈਲਰੀ ਤੁਸੀ ਲੈ ਲਉ ਪਹਿਲਾ ਤੁਹਾਡੀ ਟਰੇਨਿੰਗ ਹੋਵੇਗੀ ਛੇ ਮਹੀਨੇ ਦੀ ਛੇ ਮਹੀਨੇ ਦੀ ਟਰੇਨਿੰਗ ਤੁਸੀਂ ਲਾ ਲਉ ਤੁਹਾਨੂੰ ਦਸ ਕੁ ਹਜ਼ਾਰ ਰੁਪਇਆ ਦੇ ਦੇਣਗੇ ਫਿਰ ਉਸ ਤੋਂ ਬਾਅਦ ਤੁਹਾਡਾ ਇੱਕ ਟੈਸਟ ਹੋਵੇਗਾ ਜੇ ਤੁਸੀਂ ਟੈਸਟ ਕਲੀਅਰ ਕਰ ਲਿਆ ਫਿਰ ਤਾਂ ਤੁਹਾਡੀ ਲੱਗਦੇ ਸਾਰ ਤੁਸੀਂ ਲਾ ਲਉ ਚਾਰ ਲੱਖ ਦਾ ਪੈਕੇਜ ਹੋ ਜਾਵੇਗਾ ਜੀ ਠੀਕ ਹੈ ਫਿਰ ਚਾਰ ਲੱਖ ਦਾ ਅਤੇ ਉਹੀ ਸਾਲ ਬਾਅਦ ਫਿਰ ਤੁਹਾਡਾ ਇੰਨਕਰੀਮੈਂਟ ਹੋ ਜਾਵੇਗਾ ਚਾਰ ਤੋਂ ਤੁਸੀਂ ਲਾ ਲਉ ਛੇ ਲੱਖ ਦਾ ਹੋ ਜਾਂਦਾ ਇੱਦਾਂ ਇੱਦਾਂ ਤੁਹਾਡੇ 'ਤੇ ਡਿਪੈਂਨਡ ਕਰਦਾ ਜਿੱਦਾਂ ਤੁਸੀਂ ਆਪਣੀ ਪਰਫ਼ੋਰਮੈਂਸ ਦੇਵੋਂਗੇ ਉੱਦਾਂ ਹੀ ਤੁਹਾਡਾ ਸਾਰਾ ਕੰਮ ਹੋਵੇਗਾ ਬਾਕੀ ਔਫਿਸ ਔਫਿਸ ਮੇਰਾ ਅੱਠ ਬੀ 'ਚ ਹੈ ਜਦ ਮਰਜ਼ੀ ਆ ਜਾਉ ਹੋਰ ਵੀ ਕਿਤੇ ਹੋਰ ਜਾਣਾ ਹੋਏ ਤਾਂ ਉੱਥੇ ਵੀ ਲਵਾ ਦੇਵਾਂਗਾ ਓਕੇ ਜੀ